ਹਾਂ ਯੋਗਾ ਨੇ ਮੇਰੀ ਮਾਨਸਿਕ ਸਿਹਤ ਸੁਧਾਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ ਇਸਨੇ ਮੈਨੂੰ ਤਣਾਓ ਅਤੇ ਚਿੰਤਾ ਦਾ ਪ੍ਰਬੰਧਨ ਕਰਨਾ ਸਿਖਾਇਆ ਹੈ ਕਿਉਂਕਿ ਇਹ ਮੈਨੂੰ ਹੋਰ ਸੁਚੇਤ ਅਤੇ ਵਰਤਮਾਨ ਨਾ ਪਲ ਵਿੱਚ ਜਿਊਣ ਲਈ ਮਦਦ ਕਰਦਾ ਹੈ ਸਾਹ ਲੈਣ ਦੀਆਂ ਕਿਰਿਆਵਾਂ ਅਤੇ ਧਿਆਨ ਰਾਹੀਂ ਮੈਂ ਆਪਣੇ ਵਿਚਾਰਾਂ ਅਤੇ ਭਾਵਨਾਵਾਂ ਨੂੰ ਵਧੀਆ ਢੰਗ ਨਾਲ ਸੰਭਾਲਣਾ ਸਿੱਖਿਆ ਜਿਸ ਦੇ ਨਾਲ ਯੋਗਾ ਨੇ ਮੈਨੂੰ ਆਪਣੇ ਆਪ ਨੂੰ ਤਿਆਰ ਕਰਨ ਅਤੇ ਅਟੈਚਮੈਂਟ ਤੋਂ ਮੁਕਤ ਰਹਿਣਾ ਸਿਖਾਇਆ ਜਿਸ ਨਾਲ ਮੈਨੂੰ ਅਣਸੁੱਖਦਾਈ ਸੰਬੰਧਾਂ ਅਤੇ ਛੁਟਕਾਰਾ ਮਿਲਣ ਅਤੇ ਆਪਣੇ ਆਤਿਮ ਸੁੱਖ 'ਤੇ ਧਿਆਨ ਕੇਂਦਰ ਕਰਨ ਵਿੱਚ ਮਦਦ ਕੀਤੀ